ਮੈਂ ਸਿੱਖ ਧਰਮ ਤੋਂ ਬਿਲੋਂਗ ਕਰਦੀ ਹਾਂ ਅਤੇ ਪੰਜਾਬ ਵਿੱਚ ਕਈ ਸਾਰੇ ਵਹਿਮ ਭਰਮ ਕਰੇ ਜਾਂਦੇ ਹਨ ਜਿਵੇਂ ਕਿ ਪੰ ਕਈ ਲੋਕ ਪੰਡਤਾਂ ਕੋਲ ਜਾ ਕੇ ਪੰਡਤਾਂ ਕੋਲ ਲੰਘ ਜਾਂਦੇ ਨੇ ਵੀ ਸਾਡਾ ਵਿਆਹ ਨਹੀਂ ਹੋ ਰਿਹਾ ਅਤੇ ਉਹ ਕਹਿੰਦੇ ਨੇ ਫੇਰ ਪੰਡਤ ਉਹਨਾਂ ਨੂੰ ਕਹਿ ਦਿੰਦਾ ਵੀ ਤੁਸੀਂ ਜਿੰਦਾ ਖੋਲ੍ਹ ਆਉ ਤੁਹਾਡੇ ਕਰਮ ਬੰਦ ਨੇ ਤਾਂ ਜੇ ਤੁਸੀਂ ਚੁਰਾਹੇ 'ਚ ਜਿੰਦਾ ਖੋਲ੍ਹ ਕੇ ਆ ਜਾਉਂਗੇ ਤਾਂ ਤੁਹਾਡੇ ਕਰਮ ਖੁੱਲ੍ਹ ਜਾਣਗੇ ਤੁਹਾਡਾ ਵਿਆਹ ਹੋ ਜਾਵੇਗਾ ਅਤੇ ਕਈ ਕਹਿੰਦੇ ਨੇ ਵੀ ਬਿੱਲੀ ਰਾਹ ਕੱਟ ਜਾਵੇ ਤਾਂ ਅੱਗੇ ਨਹੀਂ ਜਾਣਾ ਚਾਹੀਦਾ ਅਤੇ ਕਈ ਕਹਿੰਦੇ ਨੇ ਕਿ ਵੀ ਜਿਵੇਂ ਕਿ ਮੰਗਲਵਾਰ ਵੀਰਵਾਰ ਸਿਰ ਨਹੀਂ ਧੋਣਾ ਚਾਹੀਦਾ ਜਾਂ ਕੱਪੜੇ ਨਹੀਂ ਧੋਣੇ ਚਾਹੀਦੇ ਤਾਂ ਕਰਕੇ ਪੰਜਾਬ ਵਿੱਚ ਬਹੁਤ ਸਾਰੇ ਵਹਿਮ ਕਰੇ ਜਾਂਦੇ ਹਨ ਤਾਂ ਕਰ ਸਾਡੇ ਪਰਿਵਾਰ ਅਤੇ ਅਸੀਂ ਇਹ ਵਹਿਮਾਂ ਵਿੱਚ ਜਮ੍ਹਾਂ ਵੀ ਵਿਸ਼ਵਾਸ ਨਹੀਂ ਰੱਖਦੇ ਅਤੇ ਕਈ ਕਹਿੰਦੇ ਨੇ ਕਿ ਵੀ ਜਿਵੇਂ ਕਿ ਵੀਰਵਾਰ ਅਤੇ ਮੰਗਲਵਾਰ ਨਹੁੰ ਨਹੀਂ ਕੱਟਣੇ ਚਾਹੀਦੇ ਇਸ ਕਰਕੇ ਅਸੀਂ ਇਹ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ ਕਿਉਂਕਿ ਸਾਡੇ ਸਿੱਖ ਧਰਮ ਵਿੱਚ ਇਹ ਵਹਿਮਾਂ ਭਰਮਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੀਗੇ